ਜੀ ਨਮਸਕਾਰ ਸਰ ਨਮਸਕਾਰ ਜੀ ਰਕੇਸ਼ ਜਨਰਲ ਸਟੋਰ ਹੈ ਸਰ ਆਪਣਾ ਫਿਰੋਜ਼ਪੁਰ ਕਲਾਂ ਸਟੇਸ਼ਨਰੀ ਦੀ ਦੁਕਾਨ ਹੈ ਜੀ ਜੀ ਜੀ ਹਾਂ ਹਾਂ ਮਿਲ ਜਾਵੇਗੀ ਸਭ ਕੁਛ ਮਿਲ ਜਾਵੇਗਾ ਏ ਟੂ ਜੈਡ ਸਾਰੀਆਂ ਆਈਟਮਾਂ ਹੈਗੀਆਂ ਸਾਡੇ ਕੋਲ ਦੱਸੋ ਤੁਹਾਨੂੰ ਕੀ ਚਾਹੀਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮਤਲਬ ਜਿੱਦਾਂ ਤੁਸੀਂ ਚਾਰਟ ਕਹਿ ਰਹੇ ਹੋ ਚਾਰਟ ਦਾ ਰੇਟ ਹੈ ਸਾਡਾ ਆਪਣਾ ਤੁਹਾਨੂੰ ਇਹ ਹੋਲਸੇਲ ਰੇਟ ਲਗਾਵਾਂਗੇ ਛੇ ਕੁ ਰੁਪਏ ਦਾ ਪੀਸ ਲਗਾ ਦੇਵਾਂਗੇ ਚਾਟ ਦਾ ਫੋਟੋ ਪੇਪਰ ਦਾ ਰਿੰਮ ਮਿਲ ਜਾਵੇਗਾ ਤੁਹਾਨੂੰ ਆਪਣੇ ਘੱਟੋ ਘੱਟ ਦੋ ਸੌ ਚਾਲੀ ਕੁ ਰੁਪਏ ਦਾ ਲਗਾ ਦਵਾਂਗਾ ਫੋਟੋ ਸਟੇਟ ਦਾ ਪੇਪਰ ਦਾ ਰਿੰਮ ਹੋਰ ਕੋਈ ਜਿਸ ਤਰ੍ਹਾਂ ਬੈਕਸ ਕਲਰ ਆ ਗਏ ਸਾਡੇ ਤੋਂ ਦਸ ਰੁਪਏ ਦਾ ਅਵੇਲੇਬਲ ਹੁੰਦਾ ਛੋਟਾ ਵੀਹ ਰੁਪਏ ਦਾ ਤੀਹ ਰੁਪਏ ਦਾ ਇਸ ਤੋਂ ਵੱਡਾ ਪੰਜਾਹ ਰੁਪਏ ਦਾ ਸਾਰਾ ਕੁਛ ਮਿਲ ਜਾਵੇਗਾ ਉਹ ਪੈਨਸਲਾਂ ਜਿਸ ਤਰ੍ਹਾਂ ਪੈਨਸਲਾਂ ਦਸ ਪੈਨਸਲਾਂ ਆਉਂਦੀਆਂ ਡੱਬੀ ਦੇ ਵਿੱਚ ਉਹਦੇ ਵਿੱਚ ਦਸ ਪੀਸ ਹੁੰਦੇ ਉਹ ਤੁਹਾਨੂੰ ਅਸੀਂ ਮਤਲਬ ਚਾਲੀ ਕੁ ਰੁਪਏ ਦਾ ਲਗਾ ਦੇਵਾਂਗੇ ਅਤੇ ਹਰ ਚੀਜ਼ ਦੇ ਵਿੱਚ ਡਿਸਕਾਊਂਟ ਦਿੱਤਾ ਜਾਵੇਗਾ ਹਰ ਤਰ੍ਹਾਂ ਤੁਸੀਂ ਔਡਰ ਕਰੋ ਤੁਹਾਨੂੰ ਹਰ ਚੀਜ਼ ਮਿਲ ਜਾਵੇਗੀ

ਕੌਪੀ ਜਿਹੜੀ ਜਿਸ ਤਰ੍ਹਾਂ ਤੁਸੀਂ ਮੰਨ ਲਉ ਕਿ ਅਸੀਂ ਵੀਹ ਰੁਪਏ ਵਾਲੀ ਕਾਪੀ ਬਾਰਾਂ ਪੀਸ ਲੈਂਦੇ ਨਾ ਤੁਸੀਂ ਤਾਂ ਤੁਹਾਨੂੰ ਦੋ ਸੌ ਰੁਪਏ ਦੀ ਪੈ ਜਾਂਦੀ ਜਿੱਦਾਂ ਅਸੀਂ ਦੋ ਸੌ ਚਾਲੀ ਰੁਪਏ ਦੀ ਬਣਦੀ ਹੈ ਨਾ ਤੁਹਾਨੂੰ ਦੋ ਸੌ ਰੁਪਏ ਦੀਆਂ ਬਾਰਾਂ ਪੀਸ ਪੈ ਜਾਣਗੇ ਹਾਂਜੀ ਹਾਂਜੀ ਹਾਂਜੀ ਉਹ ਜਦੋਂ ਤੁਸੀਂ ਜੀ ਜੀ ਜੀ ਜਦੋਂ ਜਦੋਂ ਮਰਜ਼ੀ ਆਓ ਅਵੇਲੇਬਲ ਹੋਵਾਂਗੇ ਅਸੀਂ ਜਿਸ ਵੇਲੇ ਮਰਜ਼ੀ ਆਓ ਜੋ ਮਰਜ਼ੀ ਖਰੀਦੋ ਤੁਹਾਡੀ ਆਪਣੀ ਦੁਕਾਨ ਹੈ ਠੀਕ ਹੈ ਠੀਕ ਹੈ ਓ ਓਕੇ ਓਕੇ